ਹੈਲੋ ਹਾਂਜੀ ਮੈਮ ਦੱਸੋ ਹਾਂਜੀ ਮੈਮ ਹੋ ਜਾਏਗਾ ਹਾਂਜੀ ਮੈਮ ਸਾਡੇ ਕੋਲ ਹੈਗੇ ਆ ਬਹੁਤ ਸਾਰੀ ਜਗ੍ਹਾ ਐਵੇਂ ਦੀਆਂ

ਹਾਂਜੀ ਮੈਮ ਉਹ ਜਿੱਦਾ ਆਪਣੇ ਆਵੇਗੀ ਨਦੀ ਵਗੈਰਾ ਉਹਦੇ ਲਾਗੇ ਤੁਹਾਨੂੰ ਮਤਲਬ ਸੰਨਸੈਟ ਹੁੰਦਾ ਵੀ ਦਿਖਾਈ ਦੇਵੇਗਾ ਤੇ ਬਹੁਤ ਵਧੀਆ ਹਰਿਆਵਲ ਵਾਲੀ ਜਗ੍ਹਾ ਹੋਵੇਗੀ ਤੇ ਮੈਮ ਉਥੇ ਬਹੁਤ ਵਧੀਆ ਤੁਹਾਡਾ ਫੋਟੋ ਸ਼ੂਟ ਹੋ ਜਾਏਗਾ ਨਹੀਂ ਨਹੀਂ ਮੈਮ ਤੁਸੀਂ ਇਹਦੀ ਤਾਂ ਗੱਲ ਛੱਡ ਦਿਓ ਇਹ ਸਾਡਾ ਰੋਜ਼ ਦਾ ਕੰਮ ਆ ਤੇ ਤੁਸੀਂ ਇਹਦੇ ਬਾਰੇ ਕੋਈ ਚਿੰਤਾ ਨਾ ਕਰੋ ਇਹਦੇ ਤੇ ਤੁਹਾਨੂੰ ਕੋਈ ਵੀ ਕੋਈ ਵੀ ਦਿੱਕਤ ਨਹੀਂ ਆਵੇਗੀ ਮੈਮ ਜਿੱਦਾ ਠੀਕ ਆ ਪੂਰੇ ਫੋਟੋਗ੍ਰਾਫੀ ਦਾ ਮੈਮ ਤੁਹਾਡਾ ਵੀਹ ਕੁ ਹਜ਼ਾਰ ਆ ਜਾਏਗਾ ਨਵੀਆਂ ਮੈਮ ਅਸੀਂ ਤੁਹਾਨੂੰ ਲੋਕੇਸ਼ਨ ਦੱਸ ਦਿੰਨੇ ਆ ਜਿੱਦਾਂ ਆਪਣੇ ਇੱਥੇ ਜਿਲਾ ਵਿੱਚ ਹੀ ਕਨਾਨਟੀ ਹਵੇਲੀ ਬਣੀ ਹੋਈ ਹੈ ਉਥੇ ਹੀ ਤੁਹਾਡਾ ਫੋਟੋ ਸ਼ੂਟ ਤੁਸੀਂ ਕਹੋਗੇ ਤੇ ਫਿਰ ਅਸੀਂ ਆਪਦੇ ਵੱਲੋਂ ਕਰਾਂਗੇ ਤੁਹਾਡੇ ਬਜਟ ਵਿੱਚ ਹੈ ਤਾਂ ਤੇ ਹਾਂ ਹਾਂ ਨਹੀਂ ਹੈਗੀਆਂ ਲੋਕੇਸ਼ਨ ਇਦਾਂ ਦੀਆਂ ਤੁਸੀਂ ਓਹ ਉਹਦੇ ਲਈ ਮੈਮ ਤੁਹਾਡਾ ਜੇ ਅਲੱਗ ਅਲੱਗ ਜਗ੍ਹਾ ਤੇ ਜਾਣਾ ਫਿਰ ਤੁਹਾਡਾ ਖਰਚਾ ਹੋ ਜਾਏਗਾ ਚਾਲੀ ਕੁ ਹਜਾਰ ਡੇਜ਼ ਅਗਰ ਤੁਸੀਂ ਕਿਸੇ ਕੰਮ ਤੇ ਨਹੀਂ ਜਾਣਾ ਵਿਹਲੇ ਹੋ ਤਾਂ ਫਿਰ ਤਾਂ ਆਪਣਾ ਹਫਤੇ ਕੁ ਦਾ ਕੰਮ ਹੈਗਾ ਆਪਾਂ ਸਾਰਾ ਕੰਪਲੀਟ ਕਰ ਦਾਂਗੇ ਅਗਰ ਤੁਹਾਨੂੰ ਕਿਤੇ ਜੋਬ ਵਗੈਰਾ ਦਾ ਕੋਈ ਹੈਗਾ ਆ ਤੇ ਫਿਰ ਆਪਣਾ ਜਿਆਦਾ ਵੀ ਦਿਨ ਲੱਗ ਸਕਦੇ ਆ ਤੇ ਉਹਦੇ ਤੁਸੀਂ ਦੱਸ ਦਿਓ ਜੇ ਆਪਣਾ ਹੈਗਾ ਆ ਬੀ ਇਕਦਮ ਕੰਮ ਆਪਣਾ ਫੋਟੋਸ਼ੂਟ ਦਾ ਕੰਪਲੀਟ ਕਰਨਾ ਤਾਂ ਆਪਾਂ ਫਿਰ ਸ਼ੁਰੂ ਕਰ ਦਾਂਗੇ ਹਾਂਜੀ ਹਾਂਜੀ ਹਾਂਜੀ ਮੈਮ ਨਹੀਂ ਮੈਮ ਉਹ ਤਾਂ ਤੁਹਾਡਾ ਆਪਣਾ ਹੀ ਖਰਚਾ ਹੋਵੇਗਾ ਰਹਿਣ ਦਾ ਤਾਂ ਤੇ ਬਾਕੀ ਕੋਈ ਗੱਲ ਨਾ ਜਿੱਥੇ ਆਪਣੀ ਹੈਗੀ ਆ ਜਾਣ ਪਛਾਣ ਆਪਾਂ ਉਥੇ ਤੁਹਾਡੇ ਲਈ ਡਿਸਕਾਊਂਟ ਵੀ ਕਰਾ ਦਾਂਗੇ ਜਿੱਥੇ ਸਾਡੇ ਮੈਮ ਇੱਥੇ ਆਪਣੇ ਕੋਲ ਥਰਟੀ ਪ੍ਰਸੈਂਟ ਡਿਸਕਾਊਂਟ ਹਾਂਜੀ ਕੋਈ ਗੱਲ ਨੀ